ਹਾਂਜੀ ਭਾਜੀ ਕਿਆ ਹਾਲ ਚਾਲ ਹੈ ਭਾਜੀ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਬੋਲਦੇ ਓਂ ਭਾਜੀ ਮੈਂ ਨਾ ਮੇਰਾ ਨਾ ਯੂਟਿਊਬ ਮੇਂ ਚੈਨਲ ਹੈ ਮੈਂ ਬਲੌਗਰ ਹੈ ਐਕਚੁਅਲੀ ਅਤੇ ਮੈਂ ਬਲੌਗ ਬਣਾਉਦਾ ਵੀਡਿਓ ਬਣਾਉਂਦਾ ਹਾਂ ਮੇਰਾ ਆਰ ਕੇ ਫੂਡ ਹਰਨੇਕ ਚੈਨਲ ਯੂਟਿਊਬ 'ਚ ਅਤੇ ਅਸੀਂ ਨਾ ਤੁਹਾਡੇ ਇੱਥੇ ਨਵਾਂ ਸ਼ਹਿਰ ਕੁਝ ਖਾਣੇ ਪੀਣੇ ਦੀ ਚੀਜ਼ਾਂ ਦਾ ਵਲੌਗ ਬਣਾਉਂਣਾ ਚਾਹੁੰਦੇ ਹਾਂ ਅਤੇ ਅਸੀਂ ਸਾਨੂੰ ਹਜੇ ਪਤਾ ਨਹੀਂ ਹੈਗਾ ਅਸੀਂ ਨਾ ਅਤੇ ਫਾਸਟ ਫੂਡ ਦੀਆਂ ਅਸੀਂ ਐਟਮਾਂ ਸਪਰਿੰਗ ਰੌਲ ਚਾਈਨਿਸ ਡਿਸ਼ਜ ਜਿੰਨੀਆਂ ਵੀ ਹੈ ਬਰਗਰ ਪੀਜ਼ਾ ਨਿਊਡਲ ਇਨ੍ਹਾਂ ਦਾ ਨਾ ਅਸੀਂ ਬਲੌਗ ਬਣਾਉਣਾ ਚਾਹੁੰਦੇ ਹਾਂ ਅਤੇ ਸਾਨੂੰ ਇੰਨਾ ਪਤਾ ਨਹੀਂ ਹੈਗਾ ਇੱਧਰ ਬਾਰੇ ਤਾਂ ਤਾਂ ਤੁਹਾਡੇ ਸਾਨੂੰ ਕਿਸੇ ਨੇ ਨੰਬਰ ਦਿੱਤਾ ਸਾਡੇ ਮੇਰੇ ਫ੍ਰੈਂਡ ਨੇ ਵੀ ਆਹ ਬੰਦਾ ਹੈਗਾ ਏ ਹੈਲਪ ਕਰਦਾ ਸਾਰਿਆਂ ਦੀ ਜਿੱਥੇ ਵੀ ਆ ਅਤੇ ਤਾਂ ਤੁਹਾਨੂੰ ਅਸੀਂ ਫ਼ੋਨ ਕੀਤਾ ਵੀ

ਅੱਛਾ ਜੀ ਅੱਛਾ ਜੀ ਅੱਛਾ ਜੀ ਕਦੋਂ ਆਈਏ ਭਾਜੀ ਫਿਰ ਵੀਡਿਓ ਹੁੰਦੀ ਹੈ ਤੁਹਾਨੂੰ ਮੋਸਟਲੀ ਦਸ ਪੰਦਰਾਂ ਮਿੰਟ ਦੀ ਵੀਡਿਓ ਹੁੰਦੀ ਹੀ ਹੁੰਦੀ ਹੈ ਜੀ

ਹਾਂਜੀ ਹਾਂਜੀ ਤੁਸੀਂ ਦੱਸ ਦਿਓ ਫਿਰ ਅਸੀਂ ਆਜੂਂਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ